ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਸਵਿਗੀ ਏਜੰਟ ਤੋਂ ਗੱਲ ਕਰਦੇ ਪਏ ਹਾਂਜੀ ਉਹ ਨਾ ਮੈਂ ਔਡਰ ਕੀਤਾ ਸੀ ਹਾਂਜੀ ਔਡਰ ਆਈ ਡੀ ਟੂ ਫੋਰ ਏਟ ਨਾਈਨ ਸੈਵਨ ਨਾਈਨ ਫੋਰ ਫਾਈਵ ਸਿਕਸ ਡਬਲ ਵਨ ਟੂ ਵਨ ਹਾਂਜੀ ਅਤੇ ਉਸ ਔਡਰ ਵਿੱਚ ਮੇਰੇ ਦੋ ਬਟਰ ਨਾਨ ਦੋ ਚਪਾਤੀ ਹਾਂਜੀ ਰਾਈਸ ਪਨੀਰ ਦਾਲ ਹਾਂਜੀ ਔਰ ਕੌਮਬੋ 'ਚ ਫਰੈਂਚ ਫਰਾਇਜ਼ ਬਰਗਰ ਔਰ ਗੁਲਾਬ ਜਾਮੁਨ ਹਾਂਜੀ ਹੋਰ ਵੀ ਕ ਦੋ ਚੀਜ਼ਾ ਹੋਣੀਆਂ ਹਾਂਜੀ ਅਤੇ ਐਕਚ ਮੈਂ ਤੁਹਾਨੂੰ ਕਹਿਣਾ ਸੀ ਕਿ ਉਹ ਨਾ ਮਤਲਬ ਰੋਂਗ ਐਡਰੈਸ 'ਤੇ ਔਡਰ ਹੋ ਗਿਆ ਉਸ ਐਡਰੈਸ 'ਤੇ ਨਾ ਮੈਂ ਮਤਲਬ ਮੇਰਾ ਔਫਿਸ ਆ ਹਾਂਜੀ ਅਤੇ ਔਫਿਸ ਤੋਂ ਨਿਕਲਦੇ ਟਾਈਮ ਮੈਂ ਔਡਰ ਕੀਤਾ ਸੀ ਅਤੇ ਉਹ ਫਿਰ ਗਲਤੀ ਨਾਲ ਮਤਲਬ ਉਹ ਵਾਲਾ ਐਡਰੈਸ ਮੇਰੇ ਕੋਲੋਂ ਫਿਲ ਹੋ ਗਿਆ ਹਾਂਜੀ ਹੋ ਉਹ ਔਫਿਸ ਮੇਰੇ ਘਰ ਤੋਂ ਕਾਫੀ ਦੂਰ ਆ ਹਾਂਜੀ ਅਤੇ ਮੇਰਾ ਘਰ ਦੀਨਾਨਗਰ ਵਿਲੇਜ ਲੋਹਗੜ੍ਹ ਹਾਂਜੀ ਤਾਂ ਤੁਸੀਂ ਇੱਕ ਵਾਰ ਰਾਈਡਰ ਨੂੰ ਬੋਲ ਦਿਓ ਕਿਉਂਕਿ ਹਜੇ ਉਹਨਾਂ ਦੀ ਲੋਕੇਸ਼ਨ ਉੱਥੇ ਹੀ ਹਜੇ ਉੱਧਰੋਂ ਉਹ ਨਿਕਲੇ ਵੀ ਨਹੀਂ ਹੋਣੇ ਹਾਂਜੀ ਕਿ ਉਹਨਾਂ ਨੂੰ ਤੰਗੀ ਨਾ ਹੋਏ ਕੋਈ ਹਾਂਜੀ ਬਾਕੀ ਮੈਂ ਗਾਈਡ ਕਰ ਦੂੰਗੀ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਮੇਰਾ ਨਿਊ ਐਡਰੈਸ ਦੇ ਦਿਓ ਤੁਸੀਂ ਹਾਂਜੀ ਅਤੇ ਉਹ ਫਿਰ ਗਲਤ ਪਤੇ 'ਤੇ ਚੱਲ ਗਿਆ ਸੀਗਾ ਮੈਨੂੰ ਪਤਾ ਹੀ ਨਹੀਂ ਲੱਗਾ ਮਤਲਬ ਮੈਂ ਜਿੱਦਾਂ ਹੀ ਆਪਣੇ ਔਫਿਸ ਤੋਂ ਬਾਹਰ ਨਿਕਲੀ ਔਰ ਮੈਂ ਔਡਰ ਕੀਤਾ ਤਾਂ ਔਡਰ ਹੋ ਗਿਆ ਗਲਤੀ ਨਾਲ ਮੇਰੀ ਲੋਕੇਸ਼ਨ ਵੀ ਉੱਥੋਂ ਦੀ ਪੈ ਗਈ ਹਾਂਜੀ ਹਾਂਜੀ ਉਹ ਕਾਫੀ ਦੂਰ ਆ ਬਾਕੀ ਤੁਸੀਂ ਉਹਨਾਂ ਨੂੰ ਬੋਲ ਦਿਉ ਇੱਕ ਵਾਰ ਅਤੇ ਮੈਂ ਉਹਨਾਂ ਨੂੰ ਗਾਈਡ ਕਰ ਦੂੰਗੀ ਅੱਗੋਂ ਹਾਂਜੀ ਓਕੇ ਹਾਂਜੀ ਠੀਕ ਧੰਨਵਾਦ